ਵੀਹ ਜਨਵਰੀ ਉੱਨੀ ਸੌ ਵੀਹ ਦੋ ਫਰਵਰੀ ਉੱਨੀ ਸੌ ਤੀਹ ਪੱਚੀ ਦਸੰਬਰ ਉੱਨੀ ਸੌ ਇਕਾਨਵੇਂ ਦੋ ਅਕਤੂਬਰ ਦੋ ਹਜ਼ਾਰ ਦਸ ਚਾਰ ਜਨਵਰੀ ਦੋ ਹਜ਼ਾਰ ਤੇਈ